ਪੇਂਡੂ ਖੇਤੀਬਾੜੀ ਵਿੱਚ ਹੁਨਰਮੰਦ ਕਿਰਤੀਆਂ ਨੂੰ ਲੱਭਣ ਅਤੇ ਉਹਨਾਂ ਨੂੰ ਕਾਇਮ ਰੱਖਣ ਵਿੱਚ ਬਹੁਤ ਚੁਣੌਤੀਆਂ ਹਨ ਪੇਂਡੂ ਭਾਰਤ ਬਾਰੇ ਇੱਕ ਆਮ ਗਲਤ ਧਾਰਨਾ ਬਣੀ ਹੋਈ ਹੈ ਕਈਆਂ ਦਾ ਮੰਨਣਾ ਹੈ ਕਿ ਪੇਂਡੂ ਭਾਰਤ ਵਿੱਚ ਆਧੁਨਿਕ ਨੌਕਰੀਆਂ ਕੈਰੀਅਰ ਦੀ ਕਾਬੀਲੀਅਤ ਸੀਮਿਤ ਹੈ ਜਿਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕੰਪਿਊਟਰ ਸਾਖਰਤਾ ਸੰਚਾਰ ਹੁਨਰ ਤਰਕ ਸ ਸੰਗਤ ਵਿਚਾਰ ਫੈਸਲਾ ਲੈਣ ਦੀ ਸਮਰੱਥਾ ਆਦਿ ਦੀ ਕਮੀ ਕਰਕੇ ਹੈ ਪਰ ਜੇ ਧਿਆਨ ਨਾਲ ਵੇਖਿਆ ਤਾਂ ਵੇਖੀਏ ਤਾਂ ਪਤਾ ਚੱਲੇਗਾ ਕਿ ਪੇਂਡੂ ਭਾਰਤ ਦਾ ਡੀ ਐਨ ਏ ਬਦਲ ਰਿਹਾ ਹੈ ਪਿੰਡਾਂ ਦੀ ਜਵਾਨ ਹੋ ਰਹੀ ਨੌਜਵਾਨ ਪੀੜ੍ਹੀ ਦੀ ਜਾਣਕਾਰੀ ਤੱਕ ਪਹੁੰਚ ਸ਼ਹਿਰੀ ਪੱਧਰ ਦੀ ਪੱਧਰ ਦੀ ਹੈ ਕਈ ਵਾਰ ਤਾਂ ਸਿੱਖਣ ਉਮੀਦੀ ਭਾਵਨਾ ਅਤੇ ਦੁਨਿਆਵੀ ਇੱਛਾਵਾਂ ਪੂਰੀਆਂ ਕਰਨ ਦੀ ਭੁੱਖ ਹੋਰ ਜ਼ਿਆਦਾ ਵਧੀ ਹੋਈ ਹੈ ਜੇ ਆਪਾਂ ਅੱਜ ਕੱਲ੍ਹ ਦਿਹਾੜੀਦਾਰਾਂ ਦੀ ਗੱਲ ਕਰੀਏ ਤਾਂ ਦਿਹਾੜੀਦਾਰ ਨੌਜ ਹੁਣ ਨੌਜਵਾਨ ਸਾਰੇ ਪਿੰਡਾਂ ਚੋਂ ਸ਼ਹਿਰ ਵੱਲ ਜਾਣਾ ਸ਼ੁਰੂ ਹੋ ਗਏ ਹਨ ਕਿਉਂਕਿ ਉਹਨਾਂ ਦੀ ਤਨਖਾਹ ਜੋ ਕਿ ਮੌਜੂਦਾ ਤਨਖਾਹ ਢਾਈ ਤਿੰਨ ਸੌ ਜ ਜਾਂ ਚਾਰ ਸੌ ਰੁਪਿਆ ਹੈ ਤਾਂ ਕਿ ਸੀਜਨ ਵਿੱਚ ਜੋ ਕਿ ਉਹ ਤਨਖਾਹ ਪੰਜ ਸੌ ਰੁਪਿਆ ਹੋ ਜਾਂਦੀ ਹੈ ਤਨ ਇਸ ਕਾਰਣ ਦਿਹਾੜੀਦਾਰਾਂ ਦੀ ਮੌਜੂਦਾ ਤਨਖਾਹ ਬਹੁਤ ਘੱਟ ਹੈ ਜਿਸ ਕਾਰਣ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਕਰਨ ਲਈ ਲੋਕ ਇੱਛੁਕ ਨਹੀਂ ਹਨ